ਬਿਜਲੀ ਦਾ ਕੱਟ ਬਿਜਲੀ ਨਾਲ ਚੱਲਣ ਵਾਲੀਆਂ ਚੀਜ਼ਾਂ 'ਤੇ ਬਹੁਤ ਜ਼ਿਆਦਾ ਅਸਰ ਕਰਦਾ ਹੈ ਅਤੇ ਮਨੁੱਖ ਦੇ ਕੰਮ 'ਤੇ ਵੀ ਬਹੁਤ ਜ਼ਿਆਦਾ ਅਸਰ ਪਾਉਂਦਾ ਹੈ ਬਿਜਲੀ ਦੇ ਕੱਟ ਦੇ ਦੌਰਾਨ ਅਸੀਂ ਆਪਣੇ ਕੰਮ ਨੂੰ ਉਨੀ ਸ ਸੱਭਿਅਤਾ ਨਾਲ ਉਨੇ ਧਿਆਨ ਦੇ ਨਾਲ ਨਹੀਂ ਕਰ ਪਾਉਂਦੇ ਜਿੰਨਾ ਅਸੀਂ ਬਿਜਲੀ ਦੀ ਮਦਦ ਦੇ ਨਾਲ ਕਰ ਪਾਉਂਦੇ ਹਾਂ ਜੇ ਕੱਟ ਲੱਗ ਜਾਵੇ ਅਤੇ ਰੋਸ਼ਨੀ ਲਈ ਇਨਵਾਟਰ ਤਾਂ ਸਾਡੇ ਘਰਾਂ 'ਚ ਲੱਗੇ ਹੁੰਦੇ ਹਨ ਪਰ ਇਨਵਰਟਰ ਦੇ ਨਾਲ ਨਾ ਮਸ਼ੀਨਾਂ ਚਲਦੀਆਂ ਹਨ ਅਤੇ ਨਾ ਹੀ ਕੋਈ ਹੋਰ ਟੈਕਨਾਲਜੀ ਵਾਲੀ ਕੋਈ ਚੀਜ਼ ਚਲਦੀ ਹੈ ਇਸਦੇ ਵਿਕਲਪ ਵਿੱਚ ਵੱਡੇ ਜਨਰੇਟਰਾਂ ਦੀ ਲੋੜ ਪੈਂਦੀ ਹੈ ਜੋ ਕਿ ਹਰ ਕੋਈ ਨਹੀਂ ਲਵਾ ਸਕਦਾ ਅਤੇ ਇਸ ਦੇ ਨਾਲ ਕੰਮ ਕਰਨ ਦੇ ਵਿੱਚ ਬਹੁਤ ਔਖ ਹੁੰਦੀ ਹੈ ਇਸ ਤੋਂ ਬਿਨਾਂ